ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਸਿੰਪਲਪ੍ਰੀਤ ਗੱਲ ਕਰ ਰਹੀ ਹਾਂ ਸਰ ਮੈਂ ਇਹ ਪੁੱਛਣਾ ਸੀਗਾ ਕਿ ਮੈਂ ਇੱਕ ਔਡਰ ਕੀਤਾ ਸੀਗਾ ਤੁਹਾਡੇ ਰੈਸਟੋਰੈਂਟ 'ਤੇ ਅਤੇ ਉਹਨੂੰ ਸਰ ਬਣਨ ਲਈ ਕਿੰਨਾ ਕੁ ਟਾਈਮ ਲੱਗੇਗਾ ਓਕੇ ਐਕਚੁਲੀ ਸਾਡੇ ਘਰ ਨਾ ਗੈਸਟ ਆਏ ਹੋਏ ਹੈ ਅਤੇ ਉਹ ਲਾਸਟ ਥਰਟੀ ਮਿੰਟ ਤੋਂ ਵੇਟ ਕਰ ਰਹੇ ਹੈ ਅਤੇ ਸਾਨੂੰ ਬਹੁਤਾ ਹੀ ਗੰਦਾ ਫੀਲ ਹੋ ਰਿਹਾ ਕਿਉਂਕਿ ਉਹ ਬੈਠੇ ਹੋਏ ਨੇ ਅਤੇ ਵੇਟ ਕਰ ਰਹੇ ਨੇ ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨਾ ਕੁ ਟਾਈਮ ਹੋਰ ਲੱਗੇਗਾ ਪਰ ਸਰ ਪੰਦਰਾਂ ਮਿੰਟ ਤਾਂ ਜ਼ਿਆਦਾ ਤੁਸੀਂ ਥੋੜ੍ਹਾ ਜਿਹਾ ਟਾਈਮ ਥੋੜ੍ਹਾ ਜਲਦੀ ਕਰੋ ਕਿਉਂਕਿ ਇੱਦਾਂ ਤਾਂ ਜੇ ਉਹ ਉੱਠ ਕੇ ਚਲੇ ਗਏ ਤਾਂ ਥੋੜ੍ਹਾ ਜਿਹਾ ਤੁਹਾਨੂੰ ਪਤਾ ਕਿ ਦੋਨਾਂ ਸਾਈਡ ਤੋਂ ਹੀ ਉਹ ਓਕਵਡ ਜਿਹਾ ਲੱਗਦਾ ਪੰਦਰਾਂ ਮਿੰਟ ਨਹੀਂ ਸਰ ਬਸ ਦਸ ਕੁ ਮਿੰਟ ਤੱਕ ਕਰਵਾ ਦਿਓ ਕਿਉਂਕਿ ਫਿਰ ਰਸਤੇ ਦੇ ਵਿੱਚ ਵੀ ਟਾਈਮ ਲੱਗੇਗਾ ਜੇ ਉਹ ਸਵਿਗੀ ਤੋਂ ਔਡਰ ਹੈਗਾ ਤੁਹਾਡਾ ਠੀਕ ਹੈ ਸਰ ਥੋੜ੍ਹਾ ਜਲਦੀ ਕਰਵਾ ਦਿਓ ਉਹਨੂੰ ਠੀਕ ਹੈ ਸਰ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਠੀਕ ਹੈ ਠੀਕ ਹੈ ਸਰ ਓਕੇ ਥੈਂਕ ਯੂ